ਜੇਕਰ ਮੈਂ ਆਪਣੇ ਪਿੰਡ ਦੀ ਸਥਾਨਕ ਖੁਰਾਕ ਦੀ ਗੱਲ ਕਰਾਂ ਤਾਂ ਮੇਰੇ ਜਿਹੜੇ ਪਿੰਡ ਦੀ ਸਥਾਨਕ ਖੁਰਾਕ ਹੈ ਉਹ ਬਦਲਦੀ ਰਹਿੰਦੀ ਹੈ ਸਮੇਂ ਸਿਰ ਉਹ ਗਰਮੀਆਂ ਦੇ ਵਿੱਚ ਕੁਝ ਹੋਰ ਹੁੰਦੀ ਹੈ ਅਤੇ ਸਰਦੀਆਂ ਦੇ ਵਿੱਚ ਕੁਝ ਹੋਰ ਹੁੰਦੀ ਹੈ ਜਿਵੇਂ ਸਰਦੀਆਂ ਦੇ ਵਿੱਚ ਇੱਥੇ ਸਰਸੋ ਦਾ ਸਾਗ ਅਤੇ ਮੱਕੀ ਦੀ ਰੋਟੀ ਬੜੀ ਕੋਮਨ ਹੋ ਜਾਂਦੀ ਹੈ ਅਤੇ ਗਰਮੀਆਂ ਦੇ ਵਿੱਚ ਜਿਵੇਂ ਅੰਬ ਅਸੀਂ ਖਾਂਦੇ ਹਾਂ ਤਾਂ ਉਹ ਬੜੇ ਕੋਮਨ ਹੋ ਜਾਂਦੇ ਨੇ ਅਤੇ ਕਣਕ ਦੀ ਰੋਟੀ ਜਿਹੜੀ ਹੈਗੀ ਹੈ ਉਹ ਸਾਰਾ ਸਾਲ ਚੱਲਦੀ ਹੈ ਅਤੇ ਸਾਡੀ ਇੱਥੇ ਜਿਹੜੇ ਹੈਗੇ ਆ ਦੇਵੀ ਦੇਵਤੇ ਜਿਹੜੇ ਹੈਗੇ ਨੇ ਉਹ ਕ ਕਈ ਨੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਸਿੱਖ ਧਰਮ ਵੀ ਹੈਗਾ ਅਤੇ ਸਾਰੇ ਪਿੰਡ ਦੇ ਵਿੱਚ ਹਿੰਦੂ ਧਰਮ ਵੀ ਹੈਗਾ ਮੁਸਲਿਮ ਧਰਮ ਵੀ ਹੈਗਾ ਅਤੇ ਇਸ ਲਈ ਸਾਡੇ ਜਿਹੜੇ ਹੈਗੇ ਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਦੇਵੀ ਦੇਵਤੇ ਜਾਂ ਫਿਰ ਜਿਹੜੇ ਅੱਲ੍ਹਾ ਹੁੰਦੇ ਨੇ ਜਾਂ ਫਿਰ ਗੁਰੂ ਜੀ ਹੈਗੇ ਨੇ ਉਹ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਵੀ ਹੈਗਾ ਆ ਸਾਡੇ ਪਿੰਡ ਦੇ ਵਿੱਚ ਗੁੱਗਾ ਮਾੜੀ ਵੀ ਹੈ ਅਤੇ ਸਾਡੇ ਪਿੰਡ ਦੇ ਵਿੱਚ ਸ਼ਿਵਜੀ ਮੰਦਿਰ ਵੀ ਹੈ ਅਤੇ ਜਦੋਂ ਗੁੱਗਾ ਮਾ ਗੁੱਗਾ ਜੀ ਦੇ ਦਿਨ ਆਉਂਦੇ ਨੇ ਗੁੱਗਾ ਜੀ ਜਨਮ ਦਿਨ ਦੇ ਦਿਨ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਅਸੀਂ ਸਵੇਰੇ ਜਿਹੜੇ ਹੈਗੇ ਆ ਮੱਥਾ ਟੇਕਣ ਲਈ ਗੁਲਗੁਲੇ ਬਣਾ ਕੇ ਲੈ ਕੇ ਜਾਂਦੇ ਹਾਂ ਅਤੇ ਉੱਥੇ ਅਸੀਂ ਇੱਕ ਬਰਤਨ ਦੇ ਵਿੱਚ ਕਣਕ ਵੀ ਲੈ ਕੇ ਜਾਂਦੇ ਹਾਂ ਤਾਂ ਕਿ ਉੱਥੇ ਚੜਾਈ ਜਾ ਸਕੇ ਅਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਅਸੀਂ ਵਾਪਿਸ ਆਉਂਦੇ ਹਾਂ ਘਰ ਅਤੇ ਆਪਣੀਆਂ ਜਿਹੜੀਆਂ ਪੂਰੀਆਂ ਨੇ ਉਹ ਵੀ ਖਾਧੀ ਜਾਂਦੀ ਉਸ ਟਾਈਮ ਦੇ ਵਿੱਚ ਅਤੇ ਜਦੋਂ ਸ਼ਿਵਰਾਤਰੀ ਹੁੰਦੀ ਹੈ ਸ਼ਿਵਰਾਤਰੀ ਦੇ ਸਮੇਂ ਉੱਥੇ ਬੜੀ ਧੂਮ ਧਾਮ ਨਾਲ ਜਿਹੜੀ ਹੈਗੀ ਸ਼ਿਵਰਾਤਰੀ ਮਨਾਈ ਜਾਂਦੀ ਆ ਸਾਡੇ ਪਿੰਡ ਦੇ ਵਿੱਚ ਉੱਥੇ ਅਸੀਂ ਜਿਹੜੀ ਭੰਗ ਹੁੰਦੀ ਹੈ ਜਿਹੜੀ ਕਿ ਭਗਵਾਨ ਭੋਲੇ ਨੂੰ ਚੜਾਈ ਜਾਂਦੀ ਹੈ ਅਤੇ ਕੁੜੀਆਂ ਜਿਹੜੀਆਂ ਕਾਫੀ ਕੁੜੀਆਂ ਜਾਂ ਫਿਰ ਜਿਹੜੀਆਂ ਔਰਤਾਂ ਨੇ ਉਹ ਵਰਤ ਰੱਖਦੀਆਂ ਨੇ ਅਤੇ ਸਵੇਰੇ ਸਵੇਰੇ ਜਿਹੜਾ ਹੈਗਾ ਉਹ ਨਹਾ ਧੋ ਕੇ ਮੱਥਾ ਟੇਕਦੀਆਂ ਨੇ ਸ਼ਿਵਜੀ ਦੇ ਮੰਦਰ 'ਚ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੁਆਰੇ ਵੀ ਜਦੋਂ ਗੁਰੂ ਜੀ ਦੇ ਜਨਮਦਿਨ ਹੁੰਦਾ ਫਿਰ ਗੁਰੂ ਜੀ ਜਿਹੜਾ ਹੈਗਾ ਸ਼ਹੀਦੀ ਦਿਵਸ ਹੁੰਦਾ ਤਾਂ ਉੱਥੇ ਜਿਹੜਾ ਹੈਗਾ ਸਾਡੇ ਗੁਰਦੁਆਰੇ ਦੇ ਵਿੱਚ ਲੰਗਰ ਵੀ ਚੱਲਦਾ ਅਤੇ ਅਸੀਂ ਜਿਹੜੇ ਸਾਰੇ ਸਾਰੇ ਹੀ ਤਿੰਨੋਂ ਧਰਮਾਂ ਨੂੰ ਬਹੁਤ ਚੰਗੀ ਤਰ੍ਹਾਂ ਜਿਹੜੇ ਤਿੰਨੋਂ ਧਰਮਾਂ ਦੇ ਚੰਗੀ ਤਿਉਹਾਰ ਨੇ ਜਾਂ ਫਿਰ ਤਿੰਨੋਂ ਧਰਮਾਂ ਦੇ ਜੋ ਚੀਜ਼ਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਮਨਾਉਂਦੇ ਹਾਂ ਕੋਈ ਭੇਦ ਭਾਵ ਨਹੀਂ ਹੁੰਦਾ ਹੈਗਾ ਅਤੇ ਸਾਡੀ ਜਿਹੜੀ ਸਥਾਨਕ ਖੁਰਾਕ ਹੈ ਉਹ ਵੀ ਜਿਹੜੀ ਹੈ ਕਦੇ ਕਦੇ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਹੈ ਅਤੇ ਸਾਰੇ ਜਿਹੜੇ ਦੇਵੀ ਦੇਵਤੇ ਨੇ ਉਹ ਉੱਥੇ ਪਿੱਤਰਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਸਾਡੇ ਪਿੰਡ ਦੇ ਵਿੱਚ ਅਤੇ ਡਿਫ ਬਹੁਤ ਤਰ੍ਹਾਂ ਦੇ ਧਰਮ ਨੇ ਜਿਹਨਾਂ ਦੇ ਅਸੀਂ ਪਾਲਣ ਕਰਦੇ ਹਾਂ ਜਿਨ੍ਹਾਂ ਦੇ ਅਸੀਂ ਪ੍ਰੰਪਰਾਵਾਂ ਨੂੰ ਨਿਭਾਉਦੇ ਹਾਂ ਅਤੇ ਸਾਡਾ ਜਿਹੜਾ ਹੈਗਾ ਇੱਕ ਸਮਾਨ ਸਾਰੇ ਧਰਮਾਂ ਨੂੰ ਦੇਖਿਆ ਜਾਂਦਾ ਹੈ